ਬਚਪਨ ਦੀਆਂ ਕੁਛ ਇਹੋ ਜਿਹੀਆਂ ਯਾਦਾਂ ਹਨ ਜੋ ਮੈਂ ਹਲੇ ਵੀ ਯਾਦ ਕਰਦਾ ਹਾਂ ਬਟ ਉਹਨਾਂ ਵਿੱਚੋਂ ਮੇਰੀ ਇੱਕ ਇਹ ਜੀ ਚੀਜ਼ ਹੈ ਜੋ ਮੈਂ ਹਲੇ ਵੀ ਵਰਤੋਂ ਵਿੱਚ ਰੱਖਦਾ ਹਾਂ ਜਿਵੇਂ ਕਿ ਜਦੋਂ ਮੈਂ ਬਚਪਨ ਵਿੱਚ ਖੇਡਦਾ ਸੀ ਜਾਂ ਮੇਰਾ ਕੋਈ ਖਿਡੋਣਾ ਖੋ ਜਾਂਦਾ ਸੀ ਤਾਂ ਮੈਂ ਇੱਕ ਮੰਤਰ ਬੋਲਦਾ ਸੀਗਾ ਕਿ ਉਹ ਚੀਜ਼ ਮੈਨੂੰ ਮਿਲ ਜਾਵੇ ਐਨ ਉਹ ਚੀਜ਼ ਜਾਂ ਤਾਂ ਮੇਰਾ ਵਹਿਮ ਸੀ ਜਾਂ ਕੁਛ ਵੀ ਸੀ ਉਹ ਚੀਜ਼ ਮੈਨੂੰ ਉਸਦੇ ਦੌਰਾਨ ਹੀ ਮਿਲ ਜਾਂਦੀ ਸੀ ਐਂਡ ਉਹ ਵਹਿਮ ਮੇਰੇ ਅੰਦਰ ਹਲੇ ਵੀ ਹੈ ਜਾਂ ਤੁਸੀਂ ਕਹਿ ਲਉ ਕਿ ਉਹ ਵਿਸ਼ਵਾਸ ਮੇਰੇ ਮਨ ਵਿੱਚ ਹਲੇ ਵੀ ਹੈ ਜੇ ਮੇਰੀ ਕੋਈ ਚੀਜ਼ ਗਵਾਚ ਜਾਵੇ ਤਾਂ ਮੈਂ ਹਲੇ ਵੀ ਜੇ ਉਹ ਉਹ ਮੰਤਰ ਬੋਲਾਂ ਤਾਂ ਉਹ ਮੇ ਉਹ ਕੋਈ ਵੀ ਚੀਜ਼ ਹੋਵੇ ਉਹ ਚੀਜ਼ ਮੈਨੂੰ ਮਿਲ ਜਾਂਦੀ ਹੈ